ਹੈਲੋ ਸਤਿ ਸ਼੍ਰੀ ਅਕਾਲ ਜੀ ਤੁਸੀਂ ਗੁਰਪ੍ਰੀਤ ਸਿੰਘ ਬੋਲ ਰਹੇ ਹੋ ਮੈਨੂੰ ਮੇਰੀ ਫਰੈਂਡ ਨੇ ਤੁਹਾਡਾ ਨੰਬਰ ਦਿੱਤਾ ਸੀਗਾ ਹਿਸਟੋਰੀਕਲ ਹਿਸਟਰੀ ਵਗੈਰਾ ਜਾਣਨੀ ਸੀ ਮੈਂਨੇ ਪੰਜਾਬ ਦੀ ਤੁਸੀਂ ਨਾਲ ਨਾਲ ਮੈਨੂੰ ਥੋੜ੍ਹਾ ਐਕਸਪਲੇਨ ਕਰਕੇ ਦੱਸ ਸਕਦੇ ਹੋ ਗੋਲਡਨ ਟੈਂਪਲ ਬਾਰੇ ਹਰੇਕ ਇਕ ਸਥਾਨ ਬਾਰੇ ਅੱ ਅੱਛਾ ਜੀ

ਅੱਛਾ ਜੀ ਅੱਛਾ ਜੀ ਤੁਸੀਂ ਅਨੰਦਪੁਰ ਸਾਹਿਬ ਗੁਰਦੁਆਰਾ ਸਾਹਿਬ ਬਾਰੇ ਕੁਛ ਐਕਸਪਲੇਨ ਕਰ ਸਕਦੇ ਹੋ ਮੈਨੂੰ ਉਸ ਗੁਰਦੁਆਰਾ ਸਾਹਿਬ ਬਾਰੇ ਜੀ ਅੱਛਾ ਜੀ ਤੁਸੀਂ ਮੈਨੂੰ ਫਤਿਹਗੜ੍ਹ ਸਾਹਿਬ ਦਾ ਇਤਿਹਾਸ ਦੱਸ ਸਕਦੇ ਹੋ ਅੱਛਾ ਜੀ ਜੀ ਜੀ ਸਰ ਠੀਕ ਹੈ ਓਕੇ